ਪੰਜਾਬ ਵਿੱਚ ਕਾਫ਼ੀ ਤਿਉਹਾਰ ਆਊਟਡੋਰ ਮਨਾਏ ਜਾਂਦੇ ਹਨ ਜਿਸ ਵਿੱਚੋਂ ਇੱਕ ਤਿਉਹਾਰ ਜੋ ਹੈ ਕਿ ਉਹ ਲੋਹੜੀ ਹੈ ਲੋਹੜੀ 'ਤੇ ਅਸੀਂ ਅੱਗ ਬਾਲ਼ਦੇ ਹਨ ਅਤੇ ਮੂੰਗਫਲੀਆਂ ਖਾਂਦੇ ਹਨ ਜਿਸ 'ਤੇ ਪ੍ਰਸਿੱਧ ਗੀਤ ਗਾਇਆ ਜਾਂਦਾ ਹੈ ਕਿ ਲੋਹੜੀ ਵੀ ਲੋਹੜੀ ਦੇ ਮਾਏ ਲੋਹੜੀ ਇਹ ਗੀਤ ਸਾਰ ਸਾਡੇ ਪੂਰਵਜ ਤੋਂ ਲੈ ਕੇ ਪਿਛਲੇ ਪੂਰਵਜ ਤੱਕ ਵੀ ਗਾਏ ਜਾਂਦੇ ਹਨ ਜਿਸ ਨਾਲ ਅੱਗੇ ਤੋਂ ਅੱਗੇ ਸਾਡੇ ਸਾਰੇ ਬੱਚਿਆਂ ਨੂੰ ਵੀ ਇਹ ਚੀਜ਼ ਦਾ ਪਤਾ ਚੱਲੇ ਕਿ ਇਹ ਤਿਉਹਾਰ ਨਾਲ ਇਹ ਗੀਤ ਦਾ ਮਹੱਤਵ ਬਹੁਤ ਜ਼ਰੂਰੀ ਹੈ